ਹਾਂਜੀ ਸਾਡੇ ਨੇੜੇ ਕਾਫੀ ਕੁਦਰਤੀ ਸਰੋਤ ਮੌਜੂਦ ਨੇ ਜਿਵੇਂ ਕਿ ਜੀ ਟੀ ਰੋਡ ਹੈ ਜਿਹੜਾ ਮੇਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਚੱਲਦਾ ਅਤੇ ਇਹ ਕੋਈ ਵੀ ਵਪਾਰਕ ਗਤੀਵਿਧੀਆਂ ਲਈ ਵਰਤਿਆ ਜਾ ਸਕਦਾ ਇਸ ਤੋਂ ਬਿਨਾਂ ਇੱਥੇ ਆਵਾਜਾਈ ਦੇ ਸਾਧਨ ਕਾਫੀ ਮਾਤਰਾ 'ਚ ਮੌਜੂਦ ਨੇ ਰਹਿੰਦੇ ਨੇ ਹਰ ਟਾਈਮ ਅਵੇਲੇਬਲ ਰਹਿੰਦੇ ਨੇ ਜਿਨਾਂ ਰਾਹੀਂ ਅਸੀਂ ਕੋਈ ਵੀ ਸਮਾਨ ਇਧਰੋਂ ਉਧਰ ਭੇਜ ਸਕਦੇ ਹਾਂ ਅਤੇ ਆਪਣੇ ਵਪਾਰਕ ਗਤੀਵਿਧੀਆਂ ਲਈ ਵਰਤ ਸਕਦੇ ਹਾਂ ਇਹੀ ਮੇਨ ਵਧੀਆ ਸੋਮੇ ਸਾਡੇ ਕੋਲ ਹੈਗੇ ਨੇ ਮੌਜੂਦ ਨੇ